ਪੰਜਾਬ ਦੇ ਵਿੱਚ ਹਰੇਕ ਸਥਾਨ 'ਤੇ ਕਾਫ਼ੀ ਸਾਰੇ ਪ੍ਰਸਿੱਧ ਸੰਗੀਤਕਾਰੀਆ ਬੈਂਡ ਪਾਏ ਜਾਂਦੇ ਨੇਗੇ ਹੈ ਨਾ ਸੈਲਾਨੀ ਦੌਰਾ ਕਰਦੇ ਸਮੇਂ ਅਸੀਂ ਬਹੁਤ ਸਾਰੇ ਹੀ ਬੈਂਡਸ ਦੇਖਦੇ ਹਾਂ ਮੈਂ ਪਟਿਆਲੇ ਤੋਂ ਬਿਲੋਂਗ ਕਰਦੀ ਹਾਂ ਤਾਂ ਕਰਕੇ ਮੈਨੂੰ ਪਟਿਆਲੇ ਬਾਰੇ ਹੀ ਪਤਾ ਹੈ ਪਟਿਆਲੇ ਦੇ ਵਿੱਚ ਅਸੀਂ ਸੈਲਾਨੀ ਦੌਰਾ ਕਰਦੇ ਸਮੇਂ ਨਾ ਨਿਊ ਸ਼ੇਰੇ ਪੰਜਾਬ ਬੈਂਡ ਦੇਖ ਸਕਦੇ ਹਾਂ ਇਹ ਜਿਹੜਾ ਬੈਂਡ ਹੈ ਨਾ ਇਹ ਸਰਕਾਰ ਦੁਆਰਾ ਹਰੇਕ ਕੰਮਾਂ ਲਈ ਵਰਤਿਆ ਜਾਂਦਾ ਜਿਵੇਂ ਕਿ ਕੋਈ ਪੰਦਰਾਂ ਅਗਸਤ ਛੱਬੀ ਜਨਵਰੀ ਜਾਂ ਕੋਈ ਹੋਰ ਸਰਕਾਰੀ ਇਵੈਂਟ ਦੇ ਹੈ ਨਾ ਮੌਕੇ 'ਤੇ ਅਸੀਂ ਇਹ ਬੈਂਡ ਨੂੰ ਦੇਖਦੇ ਹਾਂ ਅਤੇ ਇਹ ਬੈਂਡ ਪ ਆਪਣੀ ਪਰਫੋਰਮੈਂਸ ਵੀ ਬਹੁਤ ਹੀ ਵਧੀਆ ਢੰਗ ਨਾਲ਼ ਪੇਸ਼ ਕਰਦਾ ਜਿਹੜੀ ਕਿ ਸਾਰਿਆਂ ਨੂੰ ਹੀ ਇੱਕ ਦਿਲ ਖਿੱਚਵਾਂ ਦ੍ਰਿਸ਼ ਹੈ ਜਿਹੜਾ ਉਹ ਕਿ ਪ੍ਰਦਾਨ ਕਰਦੀ ਹੈ ਹੈ ਨਾ ਇਹ ਸਭ ਤੋਂ ਵਧੀਆ ਮਤਲਬ ਕਿ ਟੂਰਿੰਗ ਜਿਹੜੇ ਵੀ ਆਉਂਦੇ ਨੇ ਲੋਕ ਹੈ ਨਾ ਦੂਰੋਂ ਦੂਰੋਂ ਇਹਨੂੰ ਦੇਖਣ ਸੈਲਾਨੀ ਆਉਂਦੇ ਨੇ ਕਾਫ਼ੀ ਸਾਡੇ ਪਟਿਆਲੇ 'ਚ ਤਾਂ ਉਹਦੀ ਕਾਫ਼ੀ ਇਹਦੀ ਸ਼ਲਾਘਾ ਕਰਦੇ ਨੇ ਗੇ ਕਿਉਂਕਿ ਇਹ ਬੈਂਡ ਸਭ ਤੋਂ ਵਧੀਆ ਨੇ ਇਸ ਕਰਕੇ ਸਰਕਾਰ ਦਾ ਵੀ ਇਹਨਾਂ 'ਤੇ ਭਰੋਸਾ ਬਣਿਆ ਹੋਇਆ